ਬਾਰ੍ਹਾਂ ਅਕਤੂਬਰ ਦੋ ਹਜ਼ਾਰ ਪੰਜ ਪੱਚੀ ਦਸੰਬਰ ਦੋ ਹਜ਼ਾਰ ਸੱਤ ਪੱਚੀ ਅਗਸਤ ਉੱਨੀ ਸੌ ਬਿਆਸੀ ਪੰਜ ਜਨਵਰੀ ਦੋ ਹਜ਼ਾਰ ਨੌ ਗਿਆਰ੍ਹਾਂ ਅਪ੍ਰੈਲ ਦੋ ਹਜ਼ਾਰ ਬਾਰ੍ਹਾਂ